ਪੰਜਾਬ ਵਿੱਚ ਸੰਗਠਨ ਜਾਂ ਮਾਰਕੀਟ ਵਿੱਚ ਕੁਛ ਨਵਾਂ ਪੇਸ਼ ਕਰਨ ਲਈ ਲੋੜੀਂਦੀਆਂ ਸਾਰੀਆਂ ਗਤੀਵਿਧੀਆਂ ਦਾ ਪ੍ਰਬੰਧਕ ਕਰਨਾ ਸ਼ਾਮਿਲ ਹੁੰਦਾ ਹੈ ਇਸ ਵਿੱਚ ਵਿਚਾਰ ਪੈਦਾ ਕਰਨਾ ਸੰਕਲਪਾਂ ਦਾ ਵਿਕਾਸ ਕਰਨਾ ਰਣਨੀਤੀਆਂ ਨੂੰ ਲਾਗੂ ਕਰਨਾ ਅਤੇ ਉਤਪਾਦ ਲਾਉਣ 'ਚ ਅਤੇ ਨਵੀਆਂ ਅੰਦਰੂਨੀ ਪ੍ਰਕਿਰਿਆਂ ਨੂੰ ਸੰਭਲਣਾ ਸ਼ਾਮਿਲ ਹੈ ਪ੍ਰਭਾਵਸ਼ਾਲੀ ਇਨਵੈਂਸ਼ਨ ਮੈਨੇਜਮੈਂਟ ਪ੍ਰਤੀਯੋਗੀ ਬਣੇ ਰਹਿਣ ਲਈ ਜ਼ਰੂਰੀ ਹੈ ਕਿਉਂਕਿ ਇਹ ਸੰਸਥਾਵਾਂ ਨੂੰ ਵਿਕਸਿਤ ਕਰਨ ਬਦਲੀਆਂ ਗਾਹਕ ਲੋੜਾਂ ਦਾ ਜਵਾਬ ਦੇਣ ਅਤੇ ਨਵੀਆਂ ਤਕਨੀਕਾਂ ਨੂੰ ਅਪਣਾਉਣ ਦੇ ਯੋਗ ਬਣਾਉਂਦਾ ਹੈ ਪੰਜਾਬ ਬਹੁਤ ਜ਼ਿਆਦਾ ਸਮਰਥਨ ਕਰਦਾ ਹੈ ਉੱਦਮਤਾ ਅਤੇ ਨਵੀਨਤਾ ਦਾ ਪ੍ਰੋਗਰਾਮਾਂ ਦੀ ਪੇਸ਼ਕਸ਼ ਕਰਦਾ ਹੈ ਜੋ ਭਵਿੱਖ ਦੇ ਉਦਮੀਆਂ ਨੂੰ ਇਹਨਾਂ ਖੇਤਰਾਂ ਵਿੱਚ ਉੱਤਮ ਨਾਲ ਲਈ ਲੋੜੀਂਦਾ ਗਿਆਨ ਅਤੇ ਹੁਨਰਾਂ ਨਾਲ ਲੈਸ ਕਰਦੇ ਹਨ ਪੰਜਾਬ ਇੱਕ ਬਹੁਤ ਹੀ ਵਿਕਾਸਸ਼ੀਲ ਦੇਸ਼ ਹੈ ਨਵੀਨਤਾ ਅਤੇ ਨਵੇਂ ਉਤਪਾਦ ਵਿਕਾਸ ਪ੍ਰਬੰਧਨ ਸ਼ੰਘਰਸ਼ਲ ਅਤੇ ਗੱਲਬਾਤ ਟੀਮ ਨਿਰਮਾਣ ਅਤੇ ਪ੍ਰਬੰਧਕ ਤੋਂ ਜ਼ੋਰ ਦਿੰਦਾ ਹੈ ਇਹ ਜਾਂ ਤਾਂ ਆਪਣਾ ਕਾਰੋਬਾਰ ਸ਼ੁਰੂ ਕਰਨ ਜਾਂ ਉੱਦਮੀ ਅਤੇ ਨਵੀਨਕਾਰੀ ਸੰਸਥਾਵਾਂ ਵਿੱਚ ਕੰਮ ਕਰਨ ਵਿੱਚ ਦਿਲਚਸਪੀ ਰੱਖਣ ਵਾਲੇ ਵਿਦਿਆਰਥੀ ਜਾਂ ਉਪਭੋਗਤਾ ਲਈ ਵਿੱਦਿਅਕ ਐਕਸਪੋਜ਼ਰ ਦੀ ਡੁੰਘਾਈ ਅਤੇ ਚੌੜਾਈ ਪ੍ਰਦਾਨ ਕਰਦਾ ਹੈ ਸਮਾਨ ਸੋਚ ਵਾਲੇ ਲੋਕ ਦੇ ਨਾਲ ਇੱਕ ਨੈਟਵਰਕ ਬਣਾਉਂਦਾ ਹੈ ਅਤੇ ਉਹਨਾਂ ਦੇ ਪ੍ਰੋਜੈਕਟਾਂ 'ਤੇ ਕੰਮ ਕਰਨ ਦਾ ਮੌਕਾ ਦਿੰਦਾ ਹੈ ਐਮ ਐਸ ਐਮ ਏ ਵਰਗੀਆਂ ਕਈ ਕੰਪਨੀਆਂ ਹੈ ਜਿਹੜੀ ਇਹਨਾਂ ਨੂੰ ਸਹਾਇਤਾ ਦਿੰਦੀ ਹੈ ਪੈਸੇ ਪੱਖੋਂ ਅਤੇ ਜਗ੍ਹਾ ਪੱਖੋਂ ਇਸ ਲਈ ਪੰਜਾਬ ਹੋਰ ਵਿਕਾਸ ਵਿੱਚ ਜਾਂਦਾ ਪਿਆ ਹੈ